ਇੱਕ ਵਾਰ ਮੈਂ ਇੱਕ ਛੋਟੀ ਜਿਹੀ ਚਿੜੀ ਦੀ ਫੋਟੋ ਕਲਿੱਕ ਕੀਤੀ ਸੀ ਕਿਉਂਕਿ ਉਹ ਸਾਡੇ ਘਰ ਵਿੱਚ ਇੱਕ ਔਰੰਜ ਦਾ ਬੂਟਾ ਹੈ ਉਸ ਦੇ ਉੱਤੇ ਰਹਿੰਦੀ ਸੀ ਉਹ ਹਮੇਸ਼ਾ ਆਪਣੇ ਘਰ ਵਿੱਚੋਂ ਨਿਕਲ ਕੇ ਥੱਲੇ ਛਾਲ ਮਾਰ ਕੇ ਉਤਰ ਜਾਂਦੀ ਸੀ ਇਸ ਕਰਕੇ ਮੈਂ ਉਸ ਦੀ ਹੱਥ ਵਿੱਚ ਫੜ ਕੇ ਇੱਕ ਫੋਟੋ ਕਲਿੱਕ ਕੀਤੀ ਸੀ ਜੋ ਕਿ ਮੈਨੂੰ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਸੀ ਧੰਨਵਾਦ